ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਤੁਸੀਂ ਕਿਹੜੇ ਅਭਿਆਸਾਂ ਦੀ ਪਾਲਣਾ ਕਰਦੇ ਹੋ ਕੋਈ ਘਰੇਲੂ ਇਲਾਜ ਪਾਣੀ ਨੂੰ ਫਿਲਟਰ ਕਰਨ ਲਈ ਅਸੀਂ ਫਿਲਟਰ ਦਾ ਇਸਤੇਮਾਲ ਕਰਦੇ ਹਾਂ ਰੋਜ਼ਾਨਾ ਜਿੰਦਗੀ ਵਿੱਚ ਪਾਣੀ ਨੂੰ ਫਿਲਟਰ ਕਰਕੇ ਪੀਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਕੱਲ੍ਹ ਪਾਣੀ ਦੇ ਵਿੱਚ ਬਹੁਤ ਮਿਲਾਵਟ ਮਿਲਾਵਟੀ ਕਣ ਆ ਜਾਂਦੇ ਹਨ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਇਸ ਲਈ ਅਸੀਂ ਪਾਣੀ ਨੂੰ ਫਿਲਟਰ ਕਰਕੇ ਪੀਣਾ ਪਸੰਦ ਕਰਦੇ ਹਾਂ ਪਾਣੀ ਨੂੰ ਜੇਕਰ ਅਸੀਂ ਘਰੇਲੂ ਇਲਾਜ ਅਨੁਸਾਰ ਫਿਲਟਰ ਕਰਨ ਦੀ ਗੱਲਬਾਤ ਕਰੀਏ ਤਾਂ ਅਸੀਂ ਇਸ ਨੂੰ ਪੁਰਾਣੇ ਤਰੀਕੇ ਨਾਲ ਉਬਾਲਣ ਦੀ ਪ੍ਰਕਿਰਿਆ ਦੁਆਰਾ ਅਤੇ ਫਿਰ ਇਸ ਤੋਂ ਬਾਅਦ ਮਲਮਲ ਦੇ ਕੱਪੜੇ ਵਿੱਚ ਛਾਣ ਕੇ ਪੀ ਸਕਦੇ ਹਾਂ ਜਦੋਂ ਬਰਸਾਤਾਂ ਦੇ ਦਿਨ ਆਉਂਦੇ ਹਨ ਤਾਂ ਅਸੀਂ ਪੁਰਾਣੇ ਤਰੀਕੇ ਨਾਲ ਪਾਣੀ ਨੂੰ ਫਿਲਟਰ ਕਰਕੇ ਬੱਚਿਆਂ ਨੂੰ ਅਤੇ ਖੁਦ ਇਸਤੇਮਾਲ ਕਰਦੇ ਹਾਂ ਤਾਂ ਜੋ ਫਿਲਟਰ ਕੀਤੇ ਪਾਣੀ ਵਿੱਚ ਵੀ ਜੇਕਰ ਕੋਈ ਗਲਤ ਪਦਾਰਥ ਹੈ ਤਾਂ ਉਹ ਨਿਕਲ ਜਾਵੇ ਅਤੇ ਅਸੀਂ ਬਿਮਾਰੀਆਂ ਤੋਂ ਬੱਚ ਜਾਈਏ